ਸੈਲਾਨੀਆਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹ ਸਾਡੇ ਸਥਾਨ 'ਤੇ ਆਉਂਦੇ ਹਨ ਕਿਉਂਕਿ ਉੱਥੇ ਦਾ ਉਹਨਾਂ ਨੂੰ ਖਾਣ ਪੀਣ ਬਾਰੇ ਵੀ ਪਤਾ ਨਹੀਂ ਹੁੰਦਾ ਅਤੇ ਆਵਾਜਾਈ ਦਾ ਵੀ ਕੋਈ ਤਰੀਕਾ ਨਹੀਂ ਕਿ ਕਿਸ ਤਰ੍ਹਾਂ ਇੱ ਇਕ ਥਾਂ ਤੋਂ ਦੂਜੀ ਥਾਂ 'ਤੇ ਜਾਇਆ ਜਾਵੇ ਅਤੇ ਕਈ ਵਾਰ ਉੱਥੇ ਨਿਵਾਸ ਸਥਾਨ ਵਿੱਚ ਰਹਿਣ ਲਈ ਦਸਤਾਵੇਜਾਂ ਦੀ ਵੀ ਲੋੜ ਪੈਂਦੀ ਹੈ ਕਿਉਂਕੀ ਆਧਾਰ ਕਾਰਡ ਰਾਹੀਂ ਹੀ ਕੋਈ ਵੀ ਵਿਅਕਤੀ ਇੱਕ ਹੋਟਲ ਜਾਂ ਕਮਰੇ ਵਿੱਚ ਰਹਿ ਸਕਦਾ ਹੈ ਕਿਉਂਕਿ ਸੈਲਾਨੀ ਅਣਜਾਣ ਹੁੰਦੇ ਹਨ ਅਤੇ ਆਉਂਦੇ ਹਨ ਦ ਕੁਛ ਕਿਤੇ ਵੀ ਸਥਾਨ ਵਿੱਚ ਵੇਖਣ ਲਈ ਪਰ ਉਹਨਾਂ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਕਿਉਂਕਿ ਉਸ ਸਥਾਨ ਉਹਨਾਂ ਲਈ ਓਪਰਾ ਹੁੰਦਾ ਹੈ ਅਤੇ ਕਈ ਵਾਰ ਉਨ੍ਹਾਂ ਉਹ ਤਾਂ ਬਿਮਾਰ ਵੀ ਹੋ ਜਾਂਦੇ ਹਨ ਅਤੇ ਕਈ ਹੋਰ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ